ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੇ ਮੇਰੇ ਬਾਈਕਿੰਗ ਦੇ ਚਾਓ ਉੱਤੇ ਫਰਕ ਪਾਈ ਹੈ ਜਿੱਥੇ ਪਹਿਲਾਂ ਪੈਟਰੋਲ ਸੱਠ ਤੋਂ ਸੱਤਰ ਰੁਪਏ ਲੀਟਰ ਮਿਲਦਾ ਸੀ ਹੁਣ ਇਹ ਸੌ ਰੁਪਏ ਲੀਟਰ ਹੋ ਗਿਆ ਹੈ ਹੁਣ ਬਾਈਕ 'ਤੇ ਘੁੰਮਣ ਦਾ ਖਰਚਾ ਹੋਰ ਵੀ ਵੱਧ ਗਿਆ ਹੈ ਹਾਂ ਬਾਲਣ ਦੀ ਜ਼ਿਆਦਾ ਵਰਤੋਂ ਨਾਲ ਵਾਤਾਵਰਨ ਤੇ ਨੁਕਸਾਨ ਹੁੰਦਾ ਹੈ ਇਸ ਦੀ ਜ਼ਿਆਦਾ ਵਰਤੋਂ ਵਾਤਾਵਰਨ ਨੂੰ ਖਰਾਬ ਵੀ ਕਰਦੀ ਹੈ ਜਿਵੇਂ ਕਿ ਬਾਲਨ ਜਾਂ ਜੱਲਦਾ ਹੈ ਤਾਂ ਇਹ ਧੂੰਆਂ ਬਣਾਉਂਦਾ ਹੈ ਜਿਸ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ ਅਤੇ ਹੋਰ ਵੀ ਕਈ ਕਾਰਨਾਂ ਨਾਲ ਇਹ ਵਾਤਾਵਰਨ ਦੂਸ਼ਿਤ ਕਰਦਾ ਹੈ ਪਰ ਇਸ ਦੀ ਵਰਤੋਂ ਘੱਟ ਕੀਤੀ ਜਾ ਸਕਦੀ ਹੈ ਜੋ ਸੂਰਜ ਦੀ ਊਰਜਾ ਦੀ ਵਰਤੋਂ ਕੀਤੀ ਜਾ ਸਕਦੀ ਹੈ ਸੋਲਰ ਪੈਨਲਸ ਹੋਰ ਇਲੈਕਟਰੋਨਿਕ ਸਾਧਨਾਂ ਦੀ ਵਰਤੋਂ ਕਰਕੇ ਵੀ ਇਸ ਦੀ ਵਰਤੋਂ ਘਟਾਈ ਜਾ ਸਕਦੀ ਹੈ